ਪੇਂਡੂ ਲੋਕਾਂ ਨੂੰ ਕਾਨੂੰਨੀ ਸੇਵਾ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਅਨਪੜ੍ਹ ਹੁੰਦੇ ਹਨ ਜੇਕਰ ਗੱਲ ਕਰੀਏ ਪੁਲਿਸ ਸਟੇਸ਼ਨ ਦੀ ਜੇਕਰ ਕੋਈ ਪੇਂਡੂ ਵਿਅਕਤੀ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਲਿਖਾਉਣ ਜਾਂਦਾ ਹੈ ਤਾਂ ਉੱਥੇ ਦਾ ਮੁਖੀਆ ਉਹਨਾਂ ਦੀ ਰਿਪੋਰਟ ਨਹੀਂ ਲਿਖਦਾ ਉਨ੍ਹਾਂ ਨੂੰ ਗੁੰਮਰਾਹ ਕਰਕੇ ਵਾਪਸ ਭੇਜ ਦਿੰਦਾ ਹੈ ਅਤੇ ਇਸੇ ਤਰ੍ਹਾਂ ਜੇ ਅਦਾਲਤ ਦੀ ਗੱਲ ਕਰੀਏ ਤਾਂ ਜਿਹੜੇ ਵਕੀਲ ਉੱਥੇ ਬੈਠੇ ਹਨ ਉਹ ਪੇਂਡੂ ਲੋਕਾਂ ਦਾ ਸਮਾਂ ਅਤੇ ਪੈਸਾ ਬਹੁਤ ਵਿਅਰਥ ਕਰਦੇ ਹਨ ਉਹ ਜਿ ਜਿਹੜਾ ਕੰਮ ਫਰੀ ਵਿੱਚ ਵੀ ਹੋਣਾ ਹੁੰਦਾ ਹੈ ਉੱਥੇ ਦੇ ਵਕੀਲ ਉਹਨਾਂ ਤੋਂ ਪੰਜ ਪੰਜ ਸੋ ਰੁਪਈਆ ਵੀ ਲੈ ਲੈਂਦੇ ਹਨ ਅਤੇ ਉਹਨਾਂ ਨੂੰ ਕਾਫੀ ਗੱਲਾਂ ਵਿੱਚ ਉਲਝਾ ਲੈਂਦੇ ਹਨ ਅਤੇ ਉਹਨਾਂ ਦੇ ਸਮੇਂ ਦੀ ਵੀ ਕਦਰ ਨਹੀਂ ਕਰਦੇ ਇਸ ਤਰ੍ਹਾਂ ਉੱਥੇ ਉ ਅਦਾਲਤ ਦੇ ਵਕੀਲ ਉਹਨਾਂ ਦਾ ਸਮਾਂ ਅਤੇ ਪੈਸਾ ਬਹੁਤ ਖ਼ਰਾਬ ਕਰਦੇ ਹਨ